ਭੰਗੜਾ ਐਰੋਬਿਕਸ ਲਈ ਪੰਜਾਬੀ ਲੋਕਾਂ ਦੇ ਸਭ ਤੋਂ ਵੱਧ ਊਰਜਾਵਾਨ ਅਤੇ ਮਜੇਦਾਰ ਗੀਤਾਂ ਵਿੱਚੋਂ ਇੱਕ ਪੰਜਾਬੀ ਐਮਸੀ ਦੁਆਰਾ ਮੁੰਡਿਆਂ ਤੋਂ ਬਚ ਕੇ ਹੋਣਾ ਚਾਹੀਦਾ ਹੈ ਇਹ ਰਵਾਇਤੀ ਭੰਗੜੇ ਦੀਆਂ ਬੀਟਾਂ ਨੂੰ ਆਧੁਨਿਕ ਮੋੜ ਦੇ ਲਈ ਦੇ ਨਾਲ ਮਿਲਾਉਂਦੀਆਂ ਮਿਲਾਉਂਦਾ ਹੈ ਇੱਕ ਹੋਰ ਵਧੀਆ ਵਿਕਲਪ ਦਲੇਰ ਮਹਿੰਦੀ ਦੁਆਰਾ ਤੁਨਕ ਤੁਨਕ ਹੋ ਸਕਦਾ ਹੈ ਇਹ ਬਹੁਤ ਹੀ ਜੀਵਨ ਅਤੇ ਊਰਜਾ ਨਾਲ ਭਰਪੂਰ ਹੈ ਅਜਿਹੇ ਕਈ ਅਜਿਹੇ ਕਈ ਗੀਤ